ਮੈਂ ਬਾਗਬਾਨੀ ਕਰਨ ਦਾ ਸ਼ੌਂਕ ਰੱਖਦੀ ਹਾਂ ਅਤੇ ਦੂਜੇ ਲੋਕਾਂ ਨੂੰ ਵੀ ਬੂਟਾ ਲਗਾਉਣ ਵਿੱਚ ਮਦਦ ਕਰਦੀ ਰਹਿੰਦੀ ਹਾਂ ਇਸ ਦੇ ਨਾਲ ਹੀ ਮੈਂ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਵੀ ਲਿਆ ਕੇ ਦਿੱਤੇ ਹਨ ਜਿਵੇਂ ਕਿ ਪਪੀਤਾ ਅਮਰੂਦ ਨਿੰਬੂ ਨਿੰਮ ਫੁੱਲ ਕਰੇਲੇ ਦੀ ਵੇਲਾਂ ਅਤੇ ਬਹੁਤ ਸਾਰੇ ਹੋਰ ਪੌਦੇ ਵੀ ਹਨ ਮੈਂ ਉਹਨਾਂ ਨੂੰ ਇਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਸਭ ਨੂੰ ਦੱਸਦੀ ਹਾਂ ਜਿਵੇਂ ਕਿ ਪੌਦੇ ਲਗਾਉਣਾ ਉਹਨਾਂ ਨੂੰ ਕਿਹੜੀ ਖਾਦ ਪਾਉਣੀ ਇ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਪੌਦੇ ਲਗਾਉਣ ਬਾਰੇ ਉਤਸ਼ਾਹਿਤ ਕਰਦੀ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਨਾਲ ਵਾਤਾਵਰਣ ਵੀ ਸਹੀ ਰਹੇਗਾ ਲੋਕ ਵੀ ਸਿਹਤਮੰਦ ਰਹਿਣਗੇ